ਸਤਿ ਸ਼੍ਰੀ ਅਕਾਲ ਮੈਂ ਬਚਪਨ ਤੋਂ ਹੀ ਦੇਸ਼ ਲਈ ਕੁਛ ਕਰਨਾ ਚਾਹੁੰਦੀ ਸੀ ਮੈਂ ਕੰਪਿਊਟਰ ਵਿੱਚ ਮੇਰੀ ਬਹੁਤ ਰੁਚੀ ਸੀ ਅਤੇ ਇਹ ਵੱਡੀ ਹੋ ਕੇ ਮੈਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਹੀ ਕਰਕੇ ਆਪਣੀ ਰੁਚੀ ਨੂੰ ਅੱਗੇ ਵਧਾਇਆ ਅਤੇ ਉਹਨੂੰ ਆਪਣਾ ਇੱਕ ਜਜ਼ਬਾ ਬਣਾ ਲਿਆ ਮੈਂ ਚਾਹੁੰਦੀ ਹਾਂ ਕਿ ਨੌਕਰੀ ਅਤੇ ਕੈਰੀਅਰ ਵਿੱਚ ਮੈਂ ਲੋਕਾਂ ਨੂੰ ਟੈਕਨੋਲੋਜੀ ਨੂੰ ਇਸਤੇਮਾਲ ਕਰਨ ਲਈ ਇੱਕ ਨਿਯਮਿਤ ਰੂਪ ਪ੍ਰਦਾਨ ਕਰਾਂ ਤਾਂ ਕਿ ਲੋਕ ਉਹਦੇ ਉੱਤੇ ਪੂਰੇ ਤਰੀਕੇ ਨਾਲ ਆਧਾਰਿਤ ਨਾ ਰਹੇ ਆਪਣੇ ਆਪ ਨੂੰ ਵੀ ਦਿਮਾਗ਼ ਦਾ ਇਸਤੇਮਾਲ ਕਰਕੇ ਕੰਮ ਕਰੇ ਅੱਜ ਕੱਲ੍ਹ ਲੋਕ ਸਾਰੇ ਟੈਕਨੋਲੋਜੀ 'ਤੇ ਆਧਾਰਿਤ ਹੈ ਅਤੇ ਮੈਂ ਅੱਗੇ ਭਵਿੱਖ ਵਿੱਚ ਇਹ ਹੀ ਚਾਹੁੰਦੀ ਹਾਂ ਕਿ ਮੈਂ ਉਹ ਚੀਜ਼ ਘੱਟ ਕਰਾਂ ਨਾਲ ਦੀ ਨਾਲ ਆ ਆ ਆਪਣੇ ਭਵਿੱਖ ਵਿੱਚ ਇੱਕ ਸੁੱਖ ਅਤੇ ਇੱਕ ਸ਼ਾਂਤੀ ਵੀ ਚਾਹੁੰਦੀ ਹਾਂ ਜਿੱਦਾਂ ਅੱਜ ਲੋਕ ਇੱਕ ਦੂਜੇ ਦੇ ਪਿੱਛੇ ਪ੍ਰਤੀ ਪ੍ਰਤਿਯੋਗਿਤਾ ਵਾਂਗੂੰ ਹੋੜ 'ਚ ਪਏ ਆ ਮੈਂ ਉਹ ਚੀਜ਼ ਭਵਿੱਖ ਵਿੱਚ ਘੱਟ ਕਰਨਾ ਚਾਹੁੰਦੀ ਹਾਂ ਲੋਕੀਂ ਆਪਸ ਵਿੱਚ ਪਿਆਰ 'ਚ ਰਹੇ ਨਾ ਕਿ ਉਹਨਾਂ ਦੇ ਅੰਦਰ ਮਨ 'ਚ ਦ੍ਰਿੜ ਕੋਈ ਗੰਦੀ ਭਾਵਨਾ ਰਹੇ ਆਪਸ 'ਚ ਇੱਕ ਦੂਜੇ ਨਾਲ ਜਲੇ ਆਪਸ 'ਚ ਉਹ ਪਿਆਰ ਨਾਲ਼ ਰਹੇ ਮੈਂ ਇਹ ਹੀ ਚਾਹੁੰਦੀ ਹਾਂ ਅੱਗੇ ਵੀ ਧੰਨਵਾਦ